ਕਰਾ ਕਾਨੂੰਨੀ ਪੁਰਾਣੀਆਂ ਅੰਸ਼ ਅੱਜ ਕੱਲ੍ਹ ਦੀ ਨਹੀਂ ਹੈ ਅੱਜ ਕੱਲ੍ਹ ਜਿਵੇਂ ਕਿ ਚਲਾਨ ਸਿੱਧਾ ਕੱਟ ਕੇ ਘਰ ਆਏ ਜਾਂਦੇ ਹਨ ਈ ਚਲਾਨ ਉਹਦੇ ਵਿੱਚ ਕੋਈ ਸਰਕਾਰ ਅਮੀਰ ਗਰੀਬ ਨਹੀਂ ਦੇਖਦੀ ਜੋ ਕਿ ਬਹੁਤ ਵਧੀਆ ਗੱਲ ਹੈ ਜਿਵੇਂ ਕਿ ਨਸ਼ੇ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲ ਰਹੇ ਸਨ ਲੋਕਾਂ ਦੇ ਘਰ ਢਾਏ ਜਾ ਰਹੇ ਹਨ ਕੋਈ ਉਹਦੇ ਵਿੱਚ ਸਰਕਾਰ ਲਿਹਾਜ਼ ਨਹੀਂ ਕਰ ਰਹੀ ਭਾਵੇਂ ਕਿਸੇ ਨੇ ਪੰਜ ਸਾਲ ਪਹਿਲਾਂ ਘਰ ਬਣਾਇਆ ਕਿਸੇ ਨੇ ਭਾਵੇਂ ਕੱਲ੍ਹ ਬਣਾਇਆ ਭਾਵੇਂ ਅੱਜ ਬਣਾਇਆ ਉਹਨਾਂ ਸਭ ਦੇ ਚਲਾਨ ਕੱਟ ਰਹੇ ਹਨ ਸਭ ਦੇ ਘਰ ਢਾਏ ਜਾ ਰਹੇ ਹਨ ਨਸ਼ਾ ਸਾਰੇ ਕਿਤੋਂ ਚੱਕਿਆ ਜਾ ਰਿਹਾ ਹੈ ਸਰਕਾਰ ਨੇ ਇੰਨੇ ਵਧੀਆ ਸਰਕਾਰੀ ਸਕੂਲ ਬਣਾ ਤੇ ਹਨ ਕਿ ਸਾਨੂੰ ਵਧੀਆ ਸੀ ਬੀ ਐਸ ਈ ਸਕੂਲਾਂ ਦੇ ਵਿੱਚ ਜਾਣ ਦੀ ਜ਼ਰੂਰਤ ਹੀ ਨਹੀਂ ਹੈਗੀ ਉਹਨਾਂ ਦੇ ਵਿੱਚ ਹੀ ਸਾਰੇ ਟੈਕਨੋਲੋਜੀ ਕੰਪਿਊਟਰ ਸਾਰਾ ਕੁਛ ਉਹਨਾਂ ਦੇ ਵਿੱਚ ਪ੍ਰੋਵਾਈਡ ਕੀਤਾ ਹੋਇਆ ਮਤਲਬ ਬਹੁਤ ਵਧੀਆ ਸਰਕਾਰੀ ਸਕੂਲ ਬਣਾ ਤੇ ਹਨ ਕਿ ਬੱਚਿਆਂ ਨੂੰ ਦਿੱਕਤ ਨਾ ਆਵੇ ਕੋਈ ਅਮੀਰ ਗਰੀਬ ਦਾ ਕੋਈ ਸਭ ਕੁਛ ਬੰਦ ਕੀਤਾ ਹੋਇਆ ਸਰਕਾਰ ਨੇ ਅਤੇ ਇਹ ਬਹੁਤ ਵਧੀਆ ਗੱਲ ਹੈ